ਜਿਵੇਂ ਕਿ ਪੌਦਿਆਂ ਨੂੰ ਗਰਮੀ ਔਰ ਸਰਦੀ ਇੱਕ ਐਸੀ ਕੁਦਰਦੀ ਚੀਜ਼ ਹੈ ਜੋ ਕਿ ਦੋਨਾਂ ਦੀ ਮਾਰ ਪੈਂਦੀ ਹੈ ਕੁਛ ਕੁ ਪੌਦੇ ਹੁੰਦੇ ਹਨ ਜੋ ਕਿ ਇਸ ਸਮੱਸਿਆਂ ਤੋਂ ਇਹਨੂੰ ਗਰਮੀ ਵੀ ਝੱਲ ਸਕਦੇ ਹਨ ਸਰਦੀ ਵੀ ਝੱਲ ਸਕ ਲੇਕਿਨ ਕੁਛ ਕੁ ਹੈ ਜਿਵੇਂ ਕਿ ਅਸੀਂ ਇਹਨਾਂ ਨੂੰ ਬਚਾਉਣਾ ਹੈ ਔਰ ਉਹਦੇ ਵਿੱਚ ਅਸੀਂ ਕੀ ਕਰਦੇ ਹਾਂ ਜਿਵੇਂ ਕਿ ਗੰਨੇ ਦੀ ਫ਼ਸਲ ਜਦੋਂ ਛੋਟੀ ਹੁੰਦੀ ਹੈ ਉਹਦੇ ਉੱਤੇ ਜੋ ਗੰਨੇ ਦਾ ਪਹਿਲਾਂ ਹੀ ਉਤਰਿਆ ਹੋਇਆ ਛਿਲਕਾ ਹੈ ਉਸ ਦੀਆਂ ਜੜ੍ਹਾਂ ਦੇ ਵਿੱਚ ਅਸੀਂ ਪਾ ਦਿੰਦੇ ਹਾਂ ਤਾਂ ਜੋ ਤੇਜ਼ ਧੁੱਪਾਂ ਨਾ ਲੱਗੇ ਇੱਕ ਵਾਰੀ ਪਾਣੀ ਦੇਣ ਨਾਲ ਉਹ ਕਈ ਕਈ ਦਿਨਾਂ ਤੱਕ ਉਸ ਨੂੰ ਗਿੱਲਾ ਰੱਖਦਾ ਹੈ ਠੰਡਕ ਰੱਖਦਾ ਹੈ ਉਹਦੀ ਐਨੇਰਜੀ ਬਣਾਈ ਰੱਖਦਾ ਹੈ ਜ਼ਿਆਦਾ ਧੁੱਪ ਉਸ 'ਤੇ ਅਸਰ ਨਹੀਂ ਕਰਦੀ ਜਿਵੇਂ ਕਿ ਅਸੀਂ ਦੇਖਦੇ ਹਾਂ ਸਰਦੀਆਂ ਦੇ ਵਿੱਚ ਚਾਹੇ ਨਰਸਰੀ ਦੇ ਪੌਦੇ ਹੈ ਚਾਹੇ ਮਹਿੰਗੀਆਂ ਮਹਿੰਗੀਆਂ ਸਬਜੀਆਂ ਮਹਿੰਗੇ ਮਹਿੰਗੇ ਫਲ ਉਹਨਾ ਨੂੰ ਬਣਾਉਣ ਵਾਸਤੇ ਜੋ ਅੱਜ ਕੱਲ੍ਹ ਤਕਨੀਕੀ ਸ਼ੈੱਡ ਬਣਾਏ ਜਾ ਰਹੇ ਹਨ ਜਿਨ੍ਹਾਂ ਦੇ ਵਿੱਚ ਮਸ਼ੀਨੀ ਵਰਤੋਂ ਕੀਤੀ ਜਾਂਦੀ ਹੈ ਤਾਂ ਜੇ ਉਹਨਾ ਦਾ ਜੋ ਤਾਪਮਾਨ ਹੈ ਅਗਰ ਜਿੰਨਾ ਉਹਨਾਂ ਨੂੰ ਤਾਪਮਾਨ ਗਰੋਥ ਵਾਸਤੇ ਚਾਹੀਦਾ ਹੈ ਵਧਣ ਫੁੱਲਣ ਵਾਸਤੇ ਉਹ ਓਨਾਂ ਹੀ ਉਹਨਾ ਨੂੰ ਪ੍ਰੋਵਾਈਡ ਕਰ ਕਰਾ ਉਪਲਬਧ ਹੋ ਜਾਂਦਾ ਹੈ ਜਿਹਦੇ ਵਿੱਚ ਉਹਨਾਂ 'ਚ ਕੋਈ ਵੀ ਨੁਕਸਾਨ ਨਹੀਂ ਹੁੰਦਾ